ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਤਾਂ ਮਨੋਰੰਜਨ ਦੇ ਬਹੁਤ ਹੀ ਅੱਜ ਦੇ ਟਾਈਮ ਦੇ ਸਾਧਨ ਹੋ ਚੁੱਕੇ ਹਨ ਅਤੇ ਜਿਵੇਂ ਕਿ ਆਪਾਂ ਗੱਲ ਕਰਾਂਗੇ ਫਿ ਫਿਲਮਾਂ ਦੀ ਕਈ ਵਾਰ ਥਿਏਟਰ ਦੇ ਵਿੱਚ ਕੋਈ ਵੀ ਵਧੀਆ ਮੂਵੀ ਆਈ ਆਹ ਆ ਜਾਂਦੀ ਹੈ ਤਾਂ ਲੋਕ ਜ਼ਿਆਦਾਤਰ ਮੂਵੀ ਦੇਖਣਾ ਬਹੁਤ ਪਸੰਦ ਕਰਦੇ ਹਨ ਅੱਜ ਦੇ ਟਾਈਮ ਦੇ ਆਪਾਂ ਦੂਜੀ ਗੱਲ ਕਰਾਂਗੇ ਮੋਬਾਇਲ ਦੀ ਅਤੇ ਸੋਸ਼ਲ ਮੀਡੀਆ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਅੱਜ ਕੱਲ ਕੋਈ ਵੀ ਬੰਦਾ ਪੋਸਟ ਆਪਣੀ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਪਾ ਸਕਦਾ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਕੋਈ ਬੰਦਾ ਘੁੰਮਣ ਜਾਂਦਾ ਹੈ ਟਰੈਵਲਿੰਗ ਕਰਦਾ ਹੈ ਕਿਸੇ ਪ੍ਰਕਾਰ ਕੋਈ ਪ੍ਰੋਗਰਾਮ 'ਚ ਬੈਠਾ ਹੈ ਉਹ ਆਪਣੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਦੇ ਵਿੱਚ ਰਾਹੀਂ ਸਭ ਦੇ ਨਾਲ ਸ਼ੇਅਰ ਕਰ ਸਕਦਾ ਹੈ ਇਹ ਮਨੋਰੰਜਨ ਦੇ ਬਹੁਤ ਹੀ ਜ਼ਿਆਦਾ ਫੇਵਰੇਟ ਸਾਧਨ ਹਨ ਜਿਸ ਵਿੱਚ ਆਪਾਂ ਦਾ ਅੱਗੇ ਜਾ ਕੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਵਿਕਾਸ ਵੀ ਬਹੁਤ ਹੋਇਆ ਹੈ ਜਿਵੇਂ ਜਿਵੇਂ ਟਾਈਮ ਅੱਗੇ ਵੱਧਦਾ ਜਾ ਰਿਹਾ ਹੈ ਮਨੋਰੰਜਨ ਦੇ ਹੋਰ ਵੀ ਸਾਧਨ ਅੱਗੇ ਅੱਗੇ ਹੋਰ ਹੋਰ ਵੱਧਦੇ ਜਾਣਗੇ ਅਤੇ ਆਪਾਂ ਜਿਵੇਂ ਹੁਣ ਆਪਾਂ ਗੱਲ ਕੀਤੀ ਹੈ ਮਨੋਰੰਜਨ ਦੇ ਸਾਧਨਾਂ ਦੀ ਕਿ ਸੋਸ਼ਲ ਮੀਡੀਆ ਹੋ ਗਿਆ ਤੀਜੇ ਨੰਬਰ 'ਤੇ ਆਪਾਂ ਗੱਲ ਕਰਾਂਗੇ ਮੋਬਾਈਲ ਦੀ ਪਹਿਲਾਂ ਦੇ ਟਾਈਮ ਦੇ ਵਿੱਚ ਕਿਸੇ ਕੋਲ ਮੋਬਾਈਲ ਨਹੀਂ ਹੁੰਦਾ ਸੀ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਹੌਲੀ ਹੌਲੀ ਸਭ ਦੇ ਕੋਲ ਮੋਬਾਈਲ ਹੁੰਦਾ ਜਾ ਰਿਹਾ ਮੋਬਾਈਲ ਦੀ ਵੀ ਅੱਗੇ ਤੋਂ ਅੱਗੇ ਜਿਵੇਂ ਜਿਵੇਂ ਟਾਈਮ ਵੱਧਦਾ ਜਾ ਰਿਹਾ ਹੈ ਅੱਗੇ ਅੱਗੇ ਮੋਬਾਈਲ ਦੀ ਵੀ ਗਰੋਥਿੰਗ ਵੱਧਦੀ ਜਾ ਰਹੀ ਹੈ ਨਵੇਂ ਨਵੇਂ ਪ੍ਰਕਾਰ ਦੇ ਮੋਬਾਇਲ ਆਉਂਦੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਲੋਕਾਂ ਦਾ ਰੁਝਾਨ ਇੰਟਰਸਟ ਬਹੁਤ ਹੁੰਦਾ ਜਾ ਰਿਹਾ ਹੈ ਅਤੇ ਆਪਾਂ ਹੋਰ ਗੱਲ ਕਰਾਂਗੇ ਮੇਲਿਆਂ ਦੀ ਜਿਵੇਂ ਕਿ ਉਹਨਾਂ ਮੇਲਿਆਂ ਦੇ ਵਿੱਚ ਉਹ ਕੋਈ ਲੋਕਾਂ ਨੂੰ ਮੇਲੇ ਦੇਖੇ ਮੇਲੇ ਵਿੱਚ ਜਾਣਾ ਬਹੁਤ ਪਸੰਦ ਹੁੰਦਾ ਹੈ ਅ ਆਉਣ ਵਾਲੇ ਟਾਈਮ ਦੇ ਵਿੱਚ ਅਲੱਗ ਅਲੱਗ ਪ੍ਰਕਾਰ ਦੀਆਂ ਚੀਜ਼ਾਂ ਮਨੋਰੰਜਨ ਦੇ ਰ ਰਸਤੇ ਬਹੁਤ ਹੀ ਵੱਧਦੇ ਜਾਂਦੇ ਹਨ ਵਿਕਾਸ ਦੇ ਰਸਤੇ ਬਹੁਤ ਹੀ ਖੁੱਲ੍ਹਦੇ ਜਾਂਦੇ ਹਨ